ਹਾਂਜੀ ਮੈਂ ਨਾ ਆਨੰਦਪੁਰ ਵਾਲੇ ਗੁਰੂ ਮਹਾਰਾਜ ਜੀ ਦੀ ਕਿਤਾਬ ਪੜ੍ਹੀ ਸੀਗੀ ਉਹ ਗੁਰੂ ਮਹਾਰਾਜ ਜੀ ਬਹੁਤ ਬਹੁਤ ਵਧੀਆ ਹੈਗੇ ਗੁਰੂ ਮਹਾਰਾਜ ਜੀ ਸਾਡੇ ਵੀ ਉਹਨਾਂ ਦੇ ਕਿਤਾਬਾਂ ਵੀ ਬਹੁਤ ਆਉਂਦੀਆਂ ਵਾ ਆਨੰਦ ਸੰਦੇਸ਼ ਕੀ ਸਭ ਕੁਝ ਕਿੰਨਾ ਹੀ ਕਿਤਾਬਾਂ ਆਉਂਦੀਆਂ ਵਾਂ ਫਿਰ ਇਹਨਾਂ ਨੇ ਕਰਨਾ ਵੀ ਇੱਥੇ ਵ ਸਾਡੇ ਪੰਜਵੀਂ ਪਾਤਸ਼ਾਹੀ ਗੁਰੂ ਮਹਾਰਾਜ ਨੇ ਚੋਲਾ ਛੱਡਿਆ ਸੀ ਨਾ ਉਹਨਾਂ ਦੇ ਵੀ ਕਿਤਾਬ ਲਿਖੀ ਹੋਈ ਆ ਅਮਰਜੋਤੀ ਗ੍ਰੰਥ ਉਹਨਾਂ ਦੇ ਵੀ ਚੌਦ੍ਹਾਂ ਸੌ ਪੇਸ ਦੀ ਕਿਤਾਬ ਆ ਉਹ ਵੀ ਬਹੁਤ ਵਧੀਆ ਵਾ ਬਹੁਤ ਬਹੁਤ ਜਿੰਨਾ ਸਿੱਖਣ ਨੂੰ ਮਿਲਦਾ ਉਹਨਾਂ ਦੇ ਬਹੁਤ ਕੁਝ ਸਾਡੇ ਨਾ ਅਨੰਦਪੁਰ ਵਾ ਪੂਰਾ ਸ਼ਹਿਰ ਹੀ ਬਸਿਆ ਹੋਇਆ ਵਾ ਵੀ ਜਿੱਦਾ ਕੋਈ ਜਿਨਾ ਉਹਨਾਂ ਨੇ ਆਪਣਾ ਹੀ ਖਾਣਾ ਬਣਾਉਣਾ ਆਪਣੀ ਕਣਕ ਬੀਜਣੀ ਆਪਣੇ ਹੀ ਗੰਨੇ ਆਪਣੇ ਹੀ ਏ ਖੰਡ ਖੁੰਡ ਸਭ ਕੁਹਗ ਉਹਨਾਂ ਦਾ ਆਪਣੇ ਹੀ ਹੁੰਦਾ ਪ੍ਰਿੰਟਿੰਗ ਪ੍ਰੈਸ ਵੀ ਆਪਣੀ ਆ ਉਹਨਾਂ ਦੇ ਸਭ ਕੁਝ ਆਪਣਾ ਏ ਆ ਫਿਰ ਉਹਨਾਂ ਨੇ ਆਰਤੀ ਹਾਲ ਵੀ ਜਦੋਂ ਉਹਨਾਂ ਦੇ ਕਮਰੇ ਆ ਜਿੱਥੇ ਰਹਿੰਦੇ ਆ ਬਾਅਦ 'ਚ ਆਰਤੀ ਆਰਤੀ ਜਾਈਦਾ ਵਾ ਉਹ ਵੀ ਡੇਢ ਡੇਢ ਦੋ ਮੀਲ 'ਤੇ ਦੂਰ ਹੈਗਾ ਵਾ ਅਤੇ ਫਿਰ ਉਥੇ ਜਾਣਾ ਫਿਰ ਲੰਗਰ ਹਾਲ ਜਾਣਾ ਵੀ ਫਿਰ ਗੁਰੂ ਮਹਾਰਾਜ ਜੀ ਦਰਸ਼ਨ ਦਿੰਦੇ ਆ ਵੀ ਜਦੋਂ ਉਥੇ ਨਾ ਜ ਦਰਸ਼ਨ ਹਾਲ ਵਿੱਚ ਨਾ ਦਰਸ਼ਨ ਦਿੰਦੇ ਗੁਰੂ ਮਹਾਰਾਜ ਜੀ ਫਿਰ ਉਹਨਾਂ ਦੇ ਦਰਸ਼ਨ ਕਰਨ ਵੀ ਜਾਈਦਾ ਵਾ ਸਾਡਾ ਸਾਰਾ ਦਿਨ ਪਤਾ ਹੀ ਨਹੀਂ ਲੱਗਦਾ ਕਿੱਥੇ ਵੀ ਜਾਂਦਾ ਵਾ ਬਹੁਤ ਵਧੀਆ ਬਹੁਤ ਵਧੀਆ ਵਾ ਉਨ੍ਹਾਂ ਦੀ ਕਿਤਾਬ ਅਸੀਂ ਪੜ੍ਹੀ ਸੀਗੀ ਵੀ ਜਿੱਦਾਂ ਹੁਣ ਜਿਹੜੇ ਜਿਹੜੀ ਪੰਜਵੀਂ ਪਾਤਸ਼ਾਹੀ ਗੁਰੂ ਮਹਾਰਾਜ ਜੀ ਨੇ ਚੋਲਾ ਛੱਡਿਆ ਨਾ ਉਹਨਾਂ ਦੀ ਕਿਤਾਬ ਉਹਨਾਂ ਨੇ ਲਿਖੀ ਹੋਈ ਸੀਗੀ ਚੌਦ੍ਹਾਂ ਸੌ ਪ ਪੇਜਿਸ ਉਹਨਾਂ ਨੇ ਇਨੇ ਕਰਿਸ਼ਮੇ ਨਾ ਗੁਰੂ ਮਹਾਰਾਜ ਨੇ ਬਹੁਤ ਜ਼ਿਆਦਾ ਕ ਕਰਿਸ਼ਮੇ ਕੀਤੇ ਆ ਜਿਹਦਾ ਵੀ ਕੋਈ ਜੇਲ੍ਹ ਵਿੱਚ ਹੋਵੇ ਉਹਨੂੰ ਵੀ ਛਡਾ ਦਿੰਦੇ ਆ ਜਿਦਾਂ ਵੀ ਬਹੁਤ ਜ਼ਿਆਦਾ ਹੀ ਕਰਿਸ਼ਮੇ ਕੀਤੇ ਉਹਨਾਂ ਨੇ ਬਹੁਤ ਬਹੁਤ ਕਰਿਸ਼ਮੇ ਕੀਤੇ ਠੀਕ ਹੈ ਜੀ